ਆਪਣੇ ਘਰ ਦੇ ਲਈ ਗੀਜ਼ਰ ਖਰੀਦਿਆ ਸੀ ਠੰਡ ਦਾ ਮੌਸਮ ਕਰਕੇ ਗੀਜ਼ਰ ਦੀ ਲੋੜ ਸੀ ਪਰ ਵਰਤੋਂ ਕਰਨ ਤੋਂ ਬਾਅਦ ਗੀਜ਼ਰ ਦਾ ਅਨੁਭਵ ਵਧੀਆ ਨਹੀਂ ਰਿਹਾ ਕਿਉਂਕਿ ਇੱਕ ਤਾਂ ਗੀਜ਼ਰ ਬਿਜਲੀ ਬਹੁਤ ਖਾਂਦਾ ਸੀ ਅਤੇ ਨਾ ਹੀ ਪਾਣੀ ਨੂੰ ਛੇਤੀ ਗਰਮ ਕਰਦਾ ਉੱਤੋਂ ਕੁਝ ਟਾਈਮ ਹੋਇਆ ਹਾਲੇ ਇਹ ਦੋ ਵਾਰ ਖਰਾਬ ਵੀ ਹੋ ਚੁੱਕਿਆ ਅਤੇ ਇੰਨਾਂ ਮਹਿੰਗਾ ਗੀਜ਼ਰ ਲੈ ਕੇ ਮੈਨੂੰ ਪਛਤਾਵਾ ਹੀ ਹੋਇਆ ਕਿਉਂਕਿ ਇਸ ਦਾ ਮੈਨੂੰ ਕੋਈ ਫਾਇਦਾ ਨਹੀਂ ਰਿਹਾ